ਯੋਗਾ ਸੈਸ਼ਨ ਤੋਂ ਪਹਿਲਾਂ ਅਗਰ ਮੈਂ ਆਪਣੀ ਗੱਲ ਕਰਾਂ ਤਾਂ ਮੈਂ ਸਰੀਰਕ ਤੌਰ 'ਤੇ ਕਾਫ਼ੀ ਆਪਣੇ ਆਪ ਨੂੰ ਭਾਰੀਪਨ 'ਚ ਮਹਿਸੂਸ ਕਰਦਾ ਸੀ ਮੈਂ ਆਪਣੇ ਸਰੀਰ ਦੀ ਫਿਟਨੈਸ ਦੇ ਵਿੱਚ ਪਹਿਲੇ ਨਹੀਂ ਸੀ ਉਸ ਤਰ੍ਹਾਂ ਪਰ ਜਦੋਂ ਦਾ ਮੈਂ ਯੋਗਾ ਸੈਸ਼ਨ ਜੁਆਇਨ ਕੀਤਾ ਹੈ ਮੈਨੂੰ ਕਾਫ਼ੀ ਰਿਲੈਕਸ ਮਿਲਿਆ ਮੈਨੂੰ ਆਪਣੇ ਸਰੀਰ ਦੇ ਵਿੱਚ ਕਾਫ਼ੀ ਹਲਕਾਪਨ ਮਹਿਸੂਸ ਹੁੰਦਾ ਹੈ ਔਰ ਮੈਂ ਆਪਣੇ ਖਾਣ ਪੀਣ ਦੇ ਵੀ ਰੂਟੀਨ ਦੇ ਉੱਤੇ ਜੋ ਪਹਿਲਾਂ ਮੈਂ ਕਈ ਵਾਰ ਐਕਸੈਸ ਕਈ ਵਾਰ ਖਾਧਾ ਜਾਂਦਾ ਤਾਂ ਪਰ ਹੁਣ ਯੋਗਾ ਸੈਸ਼ਨ ਦਾ ਜੁਆਇਨ ਕਰਨ ਤੋਂ ਬਾਅਦ ਮੈਂ ਪ੍ਰੋਪਰ ਡਾਇਟ ਦੇ ਵਿੱਚ ਆ ਗਿਆ ਔਰ ਮੈਨੂੰ ਇਸ ਚੀਜ਼ ਦਾ ਸ਼ਰੀਰਿਕ ਤੌਰ 'ਤੇ ਬਹੁਤ ਲਾਭ ਮਿਲਿਆ ਮਾਨਸਿਕ ਰੂਪ ਦੇ ਵਿੱਚ ਵੀ ਮੈਂ ਆਪਣੇ ਆਪ ਨੂੰ ਰਿਲੈਕਸ ਸਮਝਦਾ ਇੱਕ ਸ਼ਾਂਤ ਵਾਤਾਵਰਣ ਦੇ ਵਿੱਚ ਜਦੋਂ ਇਹ ਚੀਜ਼ਾਂ ਕਰਨ ਨੂੰ ਮਿਲਦੀਆਂ ਨੇ ਤਾਂ ਆਪਣੇ ਆਪ ਦੇ ਵਿੱਚ ਇੱਕ ਸੰਤੁਸ਼ਟੀ ਜਿਹੀ ਮੈਨੂੰ ਜ ਮਿਲਦੀ ਹੈ ਔਰ ਯੋਗਾ ਸੈਸ਼ਨ ਮੈਂ ਤਾਂ ਕਹਾਂਗਾ ਕਿ ਹਰ ਕਿਸੇ ਨੂੰ ਜੁਆਇਨ ਕਰਨਾ ਚਾਹੀਦਾ ਹੈ